ਐੱਲ ਜੀ ਟੀ ਵੀ ਲਿਆ ਸੀਗਾ ਜਿਹਦਾ ਮੈਨੂੰ ਬਹੁਤ ਹੀ ਵਧੀਆ ਸੀ ਬੱਤੀ ਇੰਚੀ ਟੀ ਵੀ ਹੈਗਾ ਅੱਜ ਉਹਨੂੰ ਘੱਟੋ ਘੱਟ ਪੰਦਰਾਂ ਸਾਲ ਹੋ ਗਏ ਨੇ ਲਏ ਨੂੰ ਪਰ ਅੱਜ ਵੀ ਉਹਦੇ ਪਿਕਚਰ ਬਿਲਕੁਲ ਸਾਫ਼ ਹੈ ਅਤੇ ਉਹ 'ਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਐੱਲ ਜੀ ਟੀ ਵੀ ਦੀ ਕੰਪਨੀ ਵੀ ਵਧੀਆ ਹੈ ਇਸ ਕਰਕੇ ਮੈਨੂੰ ਇਹਦੇ ਇਹ ਟੀ ਵੀ ਬਹੁਤ ਚੰਗਾ ਲੱਗਦਾ ਅੱਜ ਵੀ ਉਹ 'ਚ ਕੋਈ ਪ੍ਰੋਬਲਮ ਨਹੀਂ ਹੈ ਬੱਚੇ ਬੜੇ ਖੁਸ਼ ਹੋ ਕੇ ਦੇਖਦੇ ਹਨ